ਹੈਲੋ ਤੁਸੀਂ ਉਣਾਹਠ ਈਸਟਮੋਨ ਨਗਰ ਨਹੀਂ ਪਹੁੰਚੇ ਤੁਹਾਨੂੰ ਦੋ ਵਜੇ ਦਾ ਟਾਈਮ ਸੀ ਦੋ ਵਜ ਕੇ ਦਸ ਮਿੰਟ ਹੋ ਗਏ ਨੇ ਮੈਂ ਲੇਟ ਹੋ ਰਹੀ ਹਾਂ ਕਿਉਂ ਕੈਂਸਲ ਕਿਉਂ ਕਰਨੀ ਹੈ ਕੈਸ਼ ਪੇਮੈਂਟ ਨਹੀਂ ਹੋਏਗੀ ਤੁਹਾਨੂੰ ਪੇਮੈਂਟ ਤਾਂ ਔਨਲਾਈਨ ਹੀ ਹੋਏਗੀ ਠੀਕ ਹੈ ਮੈਂ ਏਜੰਸੀ ਵਾਲਿਆਂ ਨਾਲ਼ ਗੱਲ ਕਰ ਲੈਂਦੀ ਹਾਂ ਹੈਲੋ ਹਾਂਜੀ ਤੁਹਾਡਾ ਡਰਾਈਵਰ ਬਘੇਲ ਸਿੰਘ ਨਾਂਹ ਕਰ ਰਿਹਾ ਹੈ ਕਿ ਮੈਂ ਪੇਮੈਂਟ ਜਿਹੜੀ ਹੈ ਕੈਸ਼ ਲੈਣੀ ਹੈ ਜਦਕਿ ਰੂਲ ਬਣਿਆ ਹੋਇਆ ਕਿ ਪੇਮੈਂਟ ਔਨਲਾਈਨ ਹੋਏਗੀ ਠੀਕ ਹੈ ਫਿਰ ਤੁਸੀਂ ਕਿਸੇ ਨੂੰ ਦਸ ਮਿੰਟ ਵਿੱਚ ਭੇਜੋ ਉਣਾਹਠ ਈਸਟਮੋਨ ਨਗਰ